ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਬੋਲ ਰਿਹਾ ਜੀ ਅਸੀਂ ਤਾਂ ਇੱਥੋਂ ਬੋਲਦੇ ਜੀ ਮੂਸੇ ਤੋਂ ਜੀ ਹਾਂਜੀ ਹਾਂਜੀ ਹਾਂਜੀ ਹਾਂ ਸਾਡੇ ਪਿੰਡ ਦਾ ਮੁੰਡਾ ਜੀ ਉਹਨੂੰ ਕੌਣ ਨਹੀਂ ਜਾਣਦਾ ਸਿੱਧੂ ਮੂਸੇਆਲਾ ਅੱਜ ਕੱਲ੍ਹ ਕੌਣ ਨਹੀਂ ਜਾਣਦਾ ਜੀ ਉਹ ਤਾਂ ਲੈ ਕੇ ਇੰਡੀਆ 'ਚ ਬਿੱਲ ਬੋਰਡ ਤੱਕ ਚੜਾਈ ਹੈ ਜੀ ਉਹਦੀ ਬਹੁ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਹਾਂਜੀ ਹਾਂ ਹਾਂ ਹਾਂ ਹਾਂ ਜਾਣਕਾਰੀ ਤੁਹਾਨੂੰ ਦੱਸ ਦਿੰਦਾ ਜੀ ਬਹੁਤ ਵਧੀਆ ਬੰਦਾ ਸੀਗਾ ਜੀ ਵਿਚਾਰਾ ਹੁਣ ਤਾਂ ਖੈਰ ਚਲਿਆ ਗਿਆ ਦੁਨੀਆਂ ਤੋਂ ਵਧੀਆ ਬੰਦਾ ਸੀਗਾ ਜੀ ਹਾਂ ਪਰਿਵਾਰ ਹਾਂ ਪਰਿਵਾਰ ਬਹੁਤ ਵਧੀਆ ਸੀਗਾ ਜੀ ਉਹਦਾ ਫੈਮਲੀ ਵਧੀਆ ਹਾਂ ਪਿਓ ਉਹਦਾ ਫੌਜੀ ਰਿਟਾਇਰ ਸੀਗਾ ਜੀ ਹਾਂ ਫਿਰ ਉਹਨਾਂ ਨੇ ਫਾਇਰ ਬਿਰਗੇਡ 'ਚ ਸਰਵਿਸ ਕਰੀ ਹੈ ਜੀ ਹਾਂ ਉੱਦੋਂ ਬਾਅਦ ਇਹ ਮਾਨਸਾ ਹੀ ਪੜੇ ਸਿੱਧੂ ਮੂਸੇ ਵਾਲਾ ਨੌਵੀਂ ਦਸਵੀਂ ਤੱਕ ਜੀ ਉੱਦੋਂ ਬਾਅਦ ਇਹਨੇ ਗ੍ਰੈਜੂਏਸ਼ਨ ਇੱਥੇ ਕਰੀ ਲੁਧਿਆਣੇ ਜੀ ਉੱਦੋਂ ਬਾਅਦ ਫਿਰ ਇਹ ਕਨੇਡਾ ਚਲਾ ਗਿਆ ਜੀ ਉੱਥੇ ਨਾਲੇ ਆਪਣੀ ਪੜ੍ਹਾਈ ਕਰੀ ਨਾਲੇ ਇਹਨੇ ਗਾਇਕੀ ਸਟਾਰਟ ਕਰੀ ਬਸ ਉੱਥੋਂ ਚਲਦਾ ਚਲਦਾ ਚਲਦਾ ਜੀ ਚੜਾਈ ਹੋ ਗਈ ਪੂਰੀ ਜੀ ਹਾਂ ਬਾਕੀ ਇਹ ਪਿੰਡ ਦੇ ਸਰਪੰਚ ਵੀ ਨੇ ਜੀ ਮੌਜੂਦਾ ਹਾਂ ਹਾਂ ਹਾਂ ਕਾਂਗਰਸ ਪਾਰਟੀ ਬਣੀ ਉਹ ਮੌਜੂਦਾ ਸਰਪੰਚ ਵੀ ਨੇ ਹਾਂ ਹਾਂ ਹਾਂ ਹਾਂ ਜਾਣਕਾਰੀ ਹਾਂਜੀ ਹਾਂ ਪੂਰੀ ਤੁਹਾਨੂੰ ਮੈਂ ਦੱਸੀ ਜਾਂਦਾ ਜੀ ਜਾਣਕਾਰੀ ਤਾਂ ਐਂ ਆ ਵੀ ਬਹੁਤ ਨਾਈਸ ਪਰਸਨ ਸੀਗੇ ਜੀ ਗਰੀਬਾਂ ਦੀ ਵਧੀਆ ਮਦਦ ਕਰਦਾ ਸੀ ਕੋਈ ਗਰੀਬ ਦਾ ਵਿਆਹ ਹੈਗਾ ਕੁੜੀ ਦਾ ਉਹਦੀ ਮਦਦ ਕਰਦਾ ਸੀਗਾ ਜੀ ਪੂਰੀ ਹਾਂ ਹੋਰ ਕੀ ਕਿਸੇ ਨੂੰ ਗਰੀਬ ਨੂੰ ਲੋੜ ਸੀ ਜੀ ਪੂਰੀ ਮਦਦ ਕਰਦਾ ਸੀਗਾ ਬਾਕੀ ਇਹਨਾਂ ਨੇ ਪਿੰਡ 'ਚ ਬਹੁਤ ਕੰਮ ਕਰਾਏ ਜੀ ਸਰਪੰਚੀ ਵੇਲੇ ਹਾਂ ਹਾਂ ਹਾਂ ਹੁਣ ਇਹਦੇ ਮੰਮੀ ਡੈਡੀ ਨੇ ਨਵੀਂ ਹਵੇਲੀ ਪਾਈ ਆ ਜੀ ਉੱਥੇ ਹੀ ਰਹਿੰਦੇ ਨੇ ਇਹਦੇ ਮੰਮੀ ਡੈਡੀ ਹਾਂ ਹਾਂ ਹਾਂਜੀ ਹਾਂ ਹਾਂ ਅਸੀਂ ਵਧੀਆ ਜਾਣਦੇ ਜੀ ਪਿੰਡ ਦੇ ਹੀ ਹਾਂ ਉਹਨਾਂ ਦੇ ਹਾਂ ਆਉਂਦੇ ਜਾਂਦੇ ਵਧੀਆ ਉਹਨਾਂ ਦੇ ਪੂਰੇ ਵਧੀਆ ਸ ਸਹਿਜਚਾਰ ਆ ਜੀ ਆਪਣੇ ਨਾਲ ਹਾਂ ਹਾਂ ਹਾਂ ਹਾਂ ਠੀਕ ਹੈ ਜੀ ਓ ਓਕੇ ਧੰਨਵਾਦ ਵੀਰ ਜੀ ਧੰਨਵਾਦ